ਹਾਂਜੀ ਮੇਰੇ ਦੋਸਤ ਮੇਰੇ ਨਾਲ ਹੀ ਬੈਠੇ ਸੀ ਉਹਨਾਂ ਦੇ ਅਚਾਨਕ ਖੁਜਲੀ ਸਟਾਰਟ ਹੋ ਗਈ ਆ ਸਾਰੇ ਪਿੰਡੇ ਦੇ ਵਿੱਚ ਜਿਹੜੀ ਖਾਰਿਸ਼ ਆ ਉਹ ਸ਼ੁਰੂ ਹੋ ਚੁੱਕੀ ਹੈ ਜਿਹਦੇ ਨਾਲ ਉਹਦੇ ਬੜਾ ਬਹੁਤ ਵੱਡੇ ਵੱਡੇ ਜਿਹੜੇ ਧੱਫੜ ਸੀਗੇ ਉਹ ਹੋ ਚੁੱਕੇ ਨੇਗੇ ਕੀ ਤੁਸੀਂ ਸਾਨੂੰ ਦੱਸ ਸਕਦੇ ਓ ਵੀ ਇਸ ਦਾ ਇਲਾਜ ਕਿਵੇਂ ਕਰਨਾ ਹੈ ਕੋਈ ਫਾਸਟ ਏਡ ਕਿਵੇਂ ਦੇਣੀ ਹੈ ਜਾਂ ਐਸੀ ਕੋਈ ਵੀ ਮੈਡੀਸਨ ਸਾਨੂੰ ਲਿਖਵਾ ਦਿਓ ਕਿ ਅਸੀਂ ਉਹ ਮੈਡੀਸਨ ਦੇ ਕੇ ਤੁਹਾਡੇ ਕੋਲੇਲਿਆ ਸਕੀਏ ਅਤੇ ਓਨਾ ਟਾਈਮ ਜਿਹੜਾ ਕਿ ਉਸ ਉਸ ਇਨਸਾਨ ਨੂੰ ਆਪਣਾ ਉਹ ਮਿਲ ਸਕੇ ਆਰਾਮ ਮਿਲ ਸਕੇ ਪਲੀਜ਼ ਸਾਨੂੰ ਇਹ ਜ਼ਰੂਰ ਦੱਸਿਆ ਦੱਸਿਆ ਜਾਵੇ ਕਿਉਂ ਕਿਉਂਕਿ ਜਿਹੜੀ ਐਲਰਜੀ ਹੁੰਦੀ ਆ ਉਹ ਕਈ ਕਾਰਨਾਂ ਕਰਕੇ ਹੋ ਜਾਂਦੀ ਆ ਉਹ ਕਿਸੇ ਦਵਾਈ ਗਲਤ ਦਵਾਈ ਖਾਣ ਨਾਲ ਵੀ ਹੋ ਸਕਦੀ ਹੈ ਜਾਂ ਕੋਈ ਕਿਸੇ ਚੀਜ਼ ਦੇ ਲੜਨ ਨਾਲ ਵੀ ਹੋ ਸਕਦੀ ਹੈ ਤਾਂ ਪਲੀਜ਼ ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਵੀ ਇਹ ਐਲਰਜੀ ਨੂੰ ਦੂਰ ਕਰਨ ਦੇ ਲਈ ਤੁਹਾਡੇ ਕੋਲ ਲੈ ਕੇ ਆਉਣ ਦੇ ਲਈ ਫਸਟ ਏਡ ਕੀ ਹੋਏਗੀ ਜਾਂ ਉਸਨੂੰ ਅਸੀਂ ਕਿਹੜੀ ਮੈਡੀਸਨ ਦੇ ਸਕਦੇ ਹਾਂ